ਹਾਂਜੀ ਤੁਸੀਂ ਫਲਿੱਪਕਾਟ ਤੋਂ ਬੋਲਦੇ ਆ ਜੀ ਅਸੀਂ ਇੱਕ ਆਇਰਨ ਮੰਗਵਾਈ ਸੀਗੀ ਅਤੇ ਉਹਦੀ ਪੈਕਿੰਗ ਵੀ ਥੋੜ੍ਹੀ ਜਿਹੀ ਲੂਸ ਸੀਗੀ ਜਦੋਂ ਯੂਜ਼ ਕੀਤੀ ਹਫਤਾ ਕੁ ਠੀਕ ਚੱਲੀ ਹੈਂਡਲ ਵੀ ਟੁੱਟਿਆ ਹੈ ਉਹਦਾ ਅਤੇ ਕੱਪੜੇ ਸਾੜ ਦਿੰਦੀ ਹੈ ਅਤੇ ਨਿਸ਼ਾਨ ਬਣ ਜਾਂਦੇ ਨੇ ਕੱਪੜੇ 'ਤੇ ਅਤੇ ਇਹ ਬਹੁਤ ਮਤਲਬ ਸਾਰਾ ਕੁਛ ਇਹਦਾ ਨੈਗੇਟਿਵ ਹੀ ਆ ਰਿਹਾ ਹੈ